ਮੈਂ ਤਸਵੀਰਾਂ ਲੈਣ ਲਈ ਹਿਮਾਚਲ ਗਿਆ ਸੀਗਾ ਉੱਥੇ ਮੰਡੀ ਆਸ ਪਾਸ ਦੇਖਿਆ ਬਹੁਤ ਪਹਾੜ ਸੀਗੇ ਉੱਥੇ ਤਸਵੀਰਾਂ ਲੈਣ ਦਾ ਮੌਕਾ ਮੈਨੂੰ ਮਿਲਿਆ ਉੱਥੇ ਦੀਆਂ ਤਸਵੀਰਾਂ ਲਈਆਂ ਮੈਂ ਬਾਕੀ ਭਾਰਤ ਦੇ ਵਿੱਚ ਤਾਂ ਬਹੁਤ ਸਾਰੇ ਸਥਾਨ ਆ ਜਿੱਥੇ ਕਿ ਅਸੀਂ ਫੋਟੋਆਂ ਲੈਣਾ ਚਾਹੁੰਦੇ ਹਾਂ ਜਿਹਨਾਂ ਵਿੱਚੋਂ ਇੱਕ ਮੁੰਬਈ ਹੈ ਸ਼ਹਿਰ ਜਿਹਦੇ ਵਿੱਚ ਕਿ ਅਸੀਂ ਚਾਹੁੰਦੇ ਹਾਂ ਕਿ ਉੱਥੋਂ ਦੀਆਂ ਫੋਟੋਆਂ ਲਈਆਂ ਜਾਣ